ਮੈਂ ਇੱਕ ਦਿਨ ਮੋਹਾਲੀ ਗਈ ਸੀ ਅਤੇ ਮੈਨੂੰ ਉੱਥੇ ਉੱਥੇ ਜਾਂਦੇ ਜਾਂਦੇ ਬਹੁਤ ਭੁੱਖ ਲੱਗ ਗਈ ਸੀ ਅਤੇ ਮੈਂ ਉੱਥੇ ਭੈਣਾਂ ਦਾ ਢਾਬੇ ਵਿੱਚ ਗਈ ਉੱਥੇ ਮੈਂ ਸੁਣਿਆ ਸੀਗਾ ਕਿਉਂਕਿ ਕਿ ਉਹ ਬਹੁਤ ਵਧੀਆ ਖਾਣਾ ਬਣਾਉਂਦੇ ਹਨ ਅਤੇ ਉੱਥੇ ਸਫ਼ਾਈ ਵੀ ਬਹੁਤ ਵਧੀਆ ਹੈ ਅਤੇ ਮੈਂ ਜਦੋਂ ਉੱਥੇ ਖਾਣਾ ਮੰਗਵਾਇਆ ਤਾਂ ਉਹ ਬਹੁਤ ਵਧੀਆ ਲੱਗਾ ਅਤੇ ਉੱਥੇ ਸਫ਼ਾਈ ਵੀ ਵਧੀਆ ਹੈ ਅਤੇ ਮੈਨੂੰ ਉਹ ਬਹੁਤ ਪਸੰਦੀਦਾ ਹ ਲੱਗਿਆ ਅਤੇ ਮੈਂ ਸਾਰਿਆਂ ਨੂੰ ਦ ਆਪਣੇ ਫਰੈਂਡਸ ਨੂੰ ਵੀ ਦੱਸਾਂਗੀ ਕਿ ਤੁਸੀਂ ਭੈਣਾਂ ਦੇ ਢਾਬੇ ਵਿੱਚ ਜਾ ਕੇ ਖਾਣਾ ਖਾਉ ਅਤੇ ਉਹ ਉਹ ਉਹਨਾਂ ਦੀ ਉਹਨਾਂ ਦੇ ਪਕਵਾਨਾਂ ਦੀ ਰੇਂਜ ਵੀ ਬਹੁਤ ਘੱਟ ਹੈ ਅਤੇ ਉਹ ਜ਼ਿਆਦਾ ਪੈਸਾ ਵੀ ਨਹੀਂ ਨਾ ਲੈਂਦੇ